ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਸਰ ਐਕਚੁਲੀ ਮੈਂ ਨਾ ਇੱਥੇ ਨਵੀਂ ਆਈ ਹਾਂ ਅਤੇ ਮੈਨੂੰ ਤੁਹਾ ਮੈਨੂੰ ਮੇਰੇ ਫਰੈਂਡ ਨੇ ਨਾ ਤੁਹਾਡਾ ਨੰਬਰ ਦਿੱਤਾ ਸੀਗਾ ਹਾਂ ਰੁਪਿੰਦਰ ਭਾਅ ਜੀ ਨੇ ਦੱਸਿਆ ਸੀ ਹਾਂਜੀ ਅਤੇ ਉਹ ਮੈਨੂੰ ਕਹਿ ਰਹੇ ਸੀ ਕਿ ਤੁਹਾਡੇ ਨਾਲ ਮਿਲ ਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਆਪਣੀ ਗੱਡੀ ਕਿੱਦਾਂ ਗੱਡੀ ਦਾ ਨੰਬਰ ਅਸਲ 'ਚ ਮੈਂ ਚੇਂਜ ਕਰਵਾਉਣਾ ਸੀ ਉਹ ਦਿੱਲੀ ਦਾ ਅਸਲ 'ਚ ਨੰਬਰ ਹੈ ਹਾਂਜੀ ਹਾਂਜੀ ਹਾਂਜੀ ਸਰ ਮੇਰੇ ਕੋਲ ਸਾਰੇ ਡਾਕੂਮੈਂਟਸ ਹੈਗੇ ਨੇ ਹਾਂਜੀ ਹਾਂਜੀ ਸਰ ਓਕੇ ਸਰ ਪੰ ਪੰਜ ਤੋਂ ਛੇ ਸਾਲ ਹੋ ਗਏ ਹੈ ਓਕੇ ਥੈਂਕ ਯੂ ਸਰ